ਸਰ ਸਤਿ ਸ਼੍ਰੀ ਅਕਾਲ ਹਾਂਜੀ ਕਿੱਦਾਂ ਕੀ ਹਾਲ ਚਾਲ ਹਾਂਜੀ ਹਾਂਜੀ ਪਹਿਚਾਣ ਲਿਆ ਮੈਂ ਮੈਂ ਰਿਹਾਨ ਦੀ ਮਦਰ ਬੋਲ ਰਹੀ ਹਾਂ ਤੁਸੀਂ ਤੁਹਾਨੂੰ ਇਹ ਸਕੂਲ ਤੇ ਮੇਅਰ ਵਟ ਦਾ ਪੜਦਾ ਤੁਹਾਡਾ ਕਿਵੇਂ ਸਕੂਲ ਪੜਦਾ ਅੱਛਾ ਮੈਂ ਸਗੋਂ ਸੋਚਦੀ ਪਈ ਸੀ ਕਿਸੀ ਪੁਲਿਸ ਦੀ ਪੇਰੈਂਟ ਨਾਲ ਵੀ ਗੱਲ ਕਰਾਂ ਤੁਹਾਡੇ ਸਕੂਲ ਕਿੱਦਾਂ ਦਾ ਹੈਗੇ ਬੱਚਿਆਂ ਦਾ ਤੁਸੀਂ ਦੱਸ ਸਕਦੇ ਹੋ ਜਲੰਧਰ ਵਿੱਚ ਕਿਹੜੇ ਸਕੂਲ ਵਧੀਆ ਮੇਅਰ ਵਰਡ ਵਧੀਆ ਸਕੂਲ ਹੈ ਮੈਨੂੰ ਪੜ੍ਹਾਈ ਇਹਨਾਂ ਦੀ ਬਹੁਤ ਵਧੀਆ ਲੱਗਦੀ ਹੈ ਬਟ ਇੱਕ ਚੀਜ਼ ਮੈਨੂੰ ਲੱਗਦੀ ਕਿ ਬਹੁਤ ਜਿਆਦਾ ਜਰੂਰਤ ਤੋਂ ਜਿਆਦਾ ਹਾਈ ਲੈਵਲ ਪੜਾਇਆ ਜਾਂਦਾ ਉਨੇ ਬੱਚਾ ਬੋਰ ਨਹੀਂ ਹੈ ਜਿੰਨਾ ਪੜਾਤੇ ਹੈ ਟੀਚਰ ਬਹੁਤ ਵਧੀਆ ਹੈ ਸਕੂਲ ਬਹੁਤ ਵਧੀਆ ਹੈਗਾ ਉਹਦੀ ਬਿਲਡਿੰਗ ਬਹੁਤ ਵਧੀਆ ਬਟ ਮੈਨੂੰ ਇਹ ਲੱਗਦਾ ਹੈ ਕਿ ਇੰਨਾਂ ਪੜਾਣਾ ਨਹੀਂ ਚਾਹੀਦਾ ਤੁਸੀਂ ਦੱਸ ਸਕਦੇ ਹੋ ਹੋਰ ਸਕੂਲ ਕਿਹੜੇ ਜਲੰਧਰ ਵਿੱਚ ਵਧੀਆ ਹੈਗੇ ਹਾਂ ਕਿਉਂਕਿ ਪਤਾ ਹੀ ਨਹੀਂ ਲੱਗਦਾ ਕਿਹੜੇ ਸਕੂਲ ਦੀ ਪੜਾਈ ਅੱਛੀ ਹ ਪੁਲਿਸ ਦੀ ਵੀ ਹੋ ਸਕਦੀ ਕਿ ਸਪੋਰਟਸ ਨੂੰ ਬਹੁਤ ਅੱਗੇ ਲੈ ਕੇ ਜਾਂਦਾ ਬੱਚਿਆਂ ਨੂੰ ਬਹੁਤ ਜਿਆਦਾ ਮੌਕੇ ਦਿੰਦਾ ਹਾਂ ਤੇ ਸਹੂਲਤਾਂ ਦਿੰਦੇ ਆ ਬੱਚਿਆਂ ਲਈ ਈਵਨਿੰਗ ਚ ਕਲਾਸਿਸ ਦਿੰਦੇ ਆ ਸਪੋਰਟਸ ਦੀ ਹੋਰ ਕੋਈ ਸਕੂਲ ਹਰ ਜਗਾ ਪੇਡ ਹੈਗੀ ਆ ਇਹ ਲੋਕ ਇਨੀ ਪੇ ਨਹੀਂ ਲੈਂਦੇ ਉਹਦੀ ਫੀਸਾਂ ਨਹੀਂ ਲੈਂਦੇ ਹਾਂ ਏਂਜਲ ਵੀ ਇੱਕ ਵਧੀਆ ਏਂਜਨ ਮੈਂ ਸੁਣਿਆ ਬਹੁਤ ਵਧੀਆ ਹੈਗਾ ਤੋ ਮਸੰਦਾ ਬਹੁਤ ਵਧੀਆ ਪਰ ਉਥੇ ਬਹੁਤ ਜਿਆਦਾ ਵਾਲੀ ਪੜ੍ਹਾਈ ਹੈਗੀ ਹ ਤੇ ਸਪੋਰਟਸ ਨੂੰ ਦਿੱਤਾ ਅਹਿਮੀਅਤ ਹਾਂ ਜਿਹੜਾ ਸਕੂਲ ਹੈਗਾ ਉਹੀ ਲੱਗਦਾ ਕਿ ਜਿੱਥੇ ਬੱਚਾ ਪੜਦਾ ਪਿਆ ਉਹ ਪੜ੍ਹੀ ਜਾਏ ਕਿਉਂਕਿ ਬਦਲਣਾ ਕਿਹੜਾ ਸੌਖਾ ਹੈਗਾ ਇੱਕ ਸਕੂਲ 'ਚ ਪਾਇਆ ਉਹਨੀਆਂ ਫੀਸਾਂ ਉਹਨਾਂ ਸਭ ਕੁਝ ਕਿੰਨਾ ਮੁਸ਼ਕਿਲਾਂ ਬਦਲੋ ਤੇ ਜਾ ਕੇ ਨਵਾਂ ਸਕੂਲ ਵੀ ਨਾ ਪਸੰਦ ਆਏ ਹੋਰ ਕਹੂੰਗਾ ਮਿਹਨਤ ਦਾ ਬਟੋਰ ਅਸੀਂ ਮਾਵਾਂ ਨੂੰ ਹੀ ਕਰਨੀਆਂ ਪੈਂਦੀਆਂ ਜਿੰਨਾ ਮਰਜ਼ੀ ਸਕੂਲ ਪੜਾਈਆਂ ਹੋਣ ਜਿਹੜਾ ਅਸੀਂ ਪੜਾਂਦੇ ਆ ਉਹਦੀ ਤਾਂ ਕੋਈ ਰੀਸ ਹੀ ਨਹੀਂ ਹੈਗੀ ਹਨਾ ਮਤਲਬ ਚੰਗਾ ਲੱਗਦਾ ਤੁਹਾਡੇ ਚਲੋ ਚੰਗਾ ਲੱਗਦਾ ਤੁਹਾਡੇ ਨਾਲ ਗੱਲ ਕਰਕੇ ਤੇ ਪਤਾ ਲੱਗਦਾ ਹੈ ਕਿ ਸਾਰੇ ਸਕੂਲ ਵਧੀਆ ਨੇ ਹਰੇਕ ਦੀ ਕੁਝ ਨਾ ਕੁਝ ਖਾਮੀਆਂ ਹਨ ਉਹਨਾਂ ਨੂੰ ਤਾਂ ਅਸੀਂ ਜੇਲ ਨਹੀਂ ਹੈ ਪਹਿਲਾਂ ਮਿਲਦੇ ਆਂ ਕਿਸੇ ਦਿਨ ਠੀਕ ਵਧੀਆ ਸਤਿ ਸ੍ਰੀ ਅਕਾਲ ਜੀ